ਧਾਰਮਿਕ ਅਭਿਆਸ ਨਾਲ ਕਈ ਛੋਟੇ ਛੋਟੇ ਕਾਰੋਬਾਰ ਜੁੜੇ ਹੋਏ ਹਨ ਜਿਵੇਂ ਕਿ ਮੈਂ ਦੇਖਦਾ ਹਾਂ ਧਾਰਮਿਕ ਖੇਤਰ ਦੇ ਵਿੱਚ ਨਾਲ ਜੁੜੇ ਕਾਰੋਬਾਰ ਦੇ ਵਿੱਚ ਜਿਵੇਂ ਕਿ ਮੈਂ ਸਿੱਖ ਧਰਮ ਨਾਲ ਸੰਬੰਧ ਹੋਣ ਕਰਕੇ ਅਕਸਰ ਦੇਖਦਾ ਹਾਂ ਕਿ ਦੁਕਾਨਾਂ ਦੇ ਉੱਤੇ ਜੋ ਕਕਾਰ ਦੇ ਰੂਪ ਜਿਹੜੇ ਹੈਗੇ ਆ ਕਕਾਰ ਦੇ ਰੂਪ ਜੋ ਸਾਡੇ ਅਸੀਂ ਮਤਲਬ ਕਿ ਜਿੰਨੇ ਜਿਸਨੇ ਵੀ ਅੰਮ੍ਰਿਤ ਛਕਿਆ ਹੈ ਉਹ ਕਕਾਰਾਂ ਦੀ ਵਰਤੋਂ ਕਰਦਾ ਹੈ ਉਹ ਅਕਸਰ ਇਹ ਇਹ ਕਾਰੋਬਾਰ ਨਾਲ ਜੁੜੇ ਹੋਏ ਲੋਕ ਜਿਹੜੇ ਹੈਗੇ ਆ ਉਹਨਾਂ ਦੀ ਮਤਲਬ ਕਿ ਉਹਨਾਂ ਨੂੰ ਵੇਚਣ ਦੇ ਵਾਸਤੇ ਉਹ ਲੈ ਕੇ ਆਉਂਦੇ ਹਨ ਇਸ ਤੋਂ ਇਲਾਵਾ ਰੁਮਾਲੇ ਹੋ ਗਏ ਧਾਰਮਿਕ ਤਸਵੀਰਾਂ ਹੋ ਗਈਆਂ ਇਸ ਤੋਂ ਇਲਾਵਾ ਧਾਰਮਿਕ ਗੁਟਕੇ ਹੋ ਗਏ ਜੋ ਅਸੀਂ ਪਾਠ ਕਰਦੇ ਹਾਂ ਇਹ ਸਾਰੇ ਹੀ ਜੋ ਧਾਰਮਿਕ ਅਸਥਾਨਾਂ ਦੇ ਇਰਦ ਗਿਰਦ ਬੈਠੇ ਛੋਟੇ ਛੋਟੇ ਕਾਰੋਬਾਰੀ ਇਹ ਚੀਜ਼ਾਂ ਨੂੰ ਸੰਗਤਾਂ ਦੇ ਵਿੱਚ ਦੇ ਕੇ ਅਤੇ ਉਨਾਂ ਦੀ ਯੋਗ ਜਥਾ ਜੋ ਭੇਟਾ ਲੈ ਲੈਂਦੇ ਹਨ ਮੈਂ ਅਕਸਰ ਹੀ ਇਹਨਾਂ ਛੋਟੇ ਕਾਰੋਬਾਰੀਆਂ ਨਾਲ ਦੇ ਕੋਲ ਜਦੋਂ ਧਾਰਮਿਕ ਕਿਤਾਬਾਂ ਵੇਖਦਾ ਹਾਂ ਉਹ ਮੇਰਾ ਬਹੁਤ ਜ਼ਿਆਦਾ ਮਤਲਬ ਕਿ ਉਹ ਉ ਪ੍ਰਭਾਵਿਤ ਕਰਦੀਆਂ ਹਨ ਮੈਂ ਉਹ ਕਿਤਾਬਾਂ ਅਕਸਰ ਹੀ ਖਰੀਦ ਲੈਂਦਾ ਹਾਂ ਇਨ੍ਹਾਂ ਜੋ ਇਸ ਖੇਤਰ ਦੇ ਨਾਲ ਜੁੜੇ ਕਾਰੋਬਾਰੀ ਹਨ ਉਹ ਧਾਰਮਿਕ ਕਿਤਾਬਾਂ ਜੋ ਕਿ ਪਾਪੂਲਰ ਬਹੁਤ ਜ਼ਿਆਦਾ ਪ੍ਰਸਿੱਧ ਹੁੰਦੀਆਂ ਹਨ ਉਹ ਅਕਸਰ ਹੀ ਉਹਨਾਂ ਦੇ ਦੁਕਾਨਾਂ ਦੇ ਉੱਤੇ ਲੱਗੀਆਂ ਹੁੰਦੀਆਂ ਹਨ ਅਤੇ ਮੇਰੀ ਅਕਸਰ ਹੀ ਨਿਗ੍ਹਾ ਉਹਨਾਂ 'ਤੇ ਜਾ ਵੜਦੀ ਹੈ ਅਤੇ ਮੈਂ ਕੋਈ ਵਧੀਆ ਜਿਹੜੀਆਂ ਕਿਤਾਬਾਂ ਹੈਗੀਆਂ ਉਹ ਸਲੈਕਟ ਕਰਕੇ ਲੈ ਆਉਂਦਾ ਹਾਂ ਅਤੇ ਫੇਰ ਮੈਂ ਉਹਨਾਂ ਨੂੰ ਪੜ੍ਹਦਾ ਹਾਂ ਇਹ ਕਿਤਾਬਾਂ ਪੜ੍ਹ ਕੇ ਜ਼ਿੰਦਗੀ ਦੇ ਵਿੱਚ ਕਾਫੀ ਚੀਜ਼ਾਂ ਦਾ ਪਤਾ ਲੱਗਦਾ ਹੈ ਅਤੇ ਕਾਫੀ ਚੀ ਮਤਲਬ ਕਿ ਪ੍ਰਭਾਵਿਤ ਹੁੰਦੀਆਂ ਹਾਂ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਜੋ ਇਹ ਕਿਤਾਬਾਂ ਹੈ ਉਹ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਚੰਗਾ ਅਸਰ ਪਾਉਂਦੀਆਂ ਹਨ